ਪੰਜਾਬ ਵਿੱਚ ਆਪਣੇ ਸਮੇਂ ਵਪਾਰ ਦੇ ਸਮਰਥਕਾਂ ਵਿੱਚ ਆਪਾਂ ਜਿੱਦਾਂ ਅਸੀਂ ਕੋਈ ਵੀ ਆਪਣਾ ਬ੍ਰੈਂਡ ਲੈਂਦੇ ਹਾਂ ਤਾਂ ਉਹਦੀ ਰਜਿਸਟਰੇਸ਼ਨ ਕਰਾਣੇ ਤੋਂ ਬਾਅਦ ਸਾਨੂੰ ਉੱਥੇ ਦੇ ਲੋਕਾਂ ਲਈ ਨਾਲ ਵਿਚਰਨਾ ਪੈਂਦਾ ਹੈ ਵਿਚਰਨ ਲਈ ਸਾਨੂੰ ਲੋਕਾਂ ਨਾਲ ਆਪਣਾ ਪਿਆਰ ਭਾਵਨਾ ਨਾਲ ਹੀ ਜਾ ਕੇ ਉਹਨਾਂ ਨੂੰ ਅਪਣਾਇਆ ਜਾ ਸਕਦਾ ਹੈ ਪਹਿਲਾਂ ਸਾਨੂੰ ਆਪਣੇ ਲੋਕਾਂ ਨੂੰ ਆਪਣੇ ਪ੍ਰੋਡਕਟ ਬਾਰੇ ਅਤੇ ਆਪਾਂ ਉਹਨਾਂ ਨੂੰ ਸਿਖਲਾਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਪੈਸ਼ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਪੈਸ਼ਨ ਬਿਜ਼ਨਸ ਬਾਰੇ ਕਿ ਪੈਸ਼ਨ ਬਿਜ਼ਨਸ 'ਚ ਕਿਆ ਕਿਆ ਫਾਇਦਾ ਹੈ ਅਤੇ ਆਪਣੇ ਪ੍ਰੋਡਕਟ ਕਿੱਦਾਂ ਵਰਤੇ ਜਾ ਸਕਦੇ ਹਨ ਅਤੇ ਉਹਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਕਿ ਅਸੀਂ ਆ ਮੈ ਮੇਰੇ ਨਾਲ ਨਾਲ ਤੁਸੀਂ ਵੀ ਅੱਗੇ ਵੱਧ ਸਕੋ ਅਤੇ ਇਸ ਲਈ ਉਹਨਾਂ ਨੂੰ ਵੀ ਇਨਕਰੇਜ ਕੀਤਾ ਜਾਂਦਾ ਹੈ ਕਿ ਤੁਸੀਂ ਵੀ ਬਿਜ਼ਨਸ ਵੱਲ ਧਿਆਨ ਦਿਉ ਆਪਣੇ ਬੱਚਿਆਂ ਨੂੰ ਬਿਜਨਸ ਗਲਤ ਨਜ਼ਰ ਧਿਆਨ ਦਿਉ ਅਤੇ ਇਸ ਲਈ ਆਪਣੀ ਕਰਮਚਾਰੀ ਅਤੇ ਕੰਡਕਟਸ ਉਹਨਾਂ ਨੂੰ ਵਧੀਆ ਇਸ ਮਿਲ ਜੁਲ ਕੇ ਸਾਰੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਇਆ ਜਾਵੇ ਅਤੇ ਉਹਨਾਂ ਨੂੰ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਕਿੱਦਾਂ ਕਿੱਦਾਂ ਅਸੀਂ ਲੋਕਾਂ ਨਾਲ ਵਿਚਰਨਾ ਹੈ ਕਿੱਦਾਂ ਕਿੱਦਾਂ ਆਪਣੇ ਆਪਣੇ ਸਾਰਾ ਕੁਝ ਕਰਨਾ ਹੈ ਅਤੇ ਆਪਣੇ ਆਪਣੇ ਖੇਤਰ ਨੂੰ ਕਿੱਦਾਂ ਅੱਗੇ ਵਧਾਉਣਾ ਹੈ ਅਤੇ ਆਪਣੇ ਕਰਮਚਾਰੀ ਕਮਚਾਰੀਆਂ ਨੂੰ ਵੀ ਬਹੁਤ ਜ਼ਿਆਦਾ ਉਹਨਾਂ ਦੀ ਮਦਦ ਕਰਨੀ ਹੈ ਜਿਸ ਨਾਲ ਉਹ ਆਪਣੇ ਸਾਰੇ ਵਿਰਸੇ ਨੂੰ ਅਤੇ ਆਪਣੇ ਸਾਡੇ ਖੇਤਰ ਨੂੰ ਆ ਅੱਗੇ ਵਧਾਉਣ ਵਿੱਚ ਸਾਡਾ ਸਮਰਥਨ ਕਰ ਸਕਣ ਇਸ ਕਾਰਨ ਅਸੀਂ ਜੋ ਵੀ ਸਾਡੇ ਨਾਲ ਹੋ ਸਾਡੇ ਨਾਲ ਦੇ ਹੋਣ ਉਹ ਵੀ ਸਾਡੇ ਨਾਲ ਅੱਗੇ ਵੱਧ ਸਕਣ ਅਤੇ ਇਸ ਨਾਲ ਸਾਡੇ ਸ ਖੇਤਰ ਦਾ ਵੀ ਬਹੁਤ ਜ਼ਿਆਦਾ ਵਪਾਰਿਕ ਖੇਤਰ ਵੱਲ ਧਿਆਨ ਅਤੇ ਸਾਡੇ ਖੇਤਰ ਦਾ ਬਹੁਤ ਜ਼ਿਆਦਾ ਉੱਪਰ ਜਾ ਸਕਦਾ ਹੈ